ਤੁਹਾਡੀ ਪਿੱਠ ਦਾ ਦਰਦ ਹੈ ਤੁਸੀਂ ਇਸ ਤਰ੍ਹਾਂ ਕਰੋ ਕਿ ਸਿੱਧੇ ਲੇਟ ਜਾਓ ਦੀਵਾਨ 'ਤੇ ਸਿੱਧਾ ਲੇਟ ਕੇ ਕੋਈ ਸਿਰਹਾਣਾ ਨਹੀਂ ਲੈਣਾ ਅਤੇ ਉਹ ਵਾਰ ਵਾਰ ਉਠਣਾ ਨਹੀਂ ਸਿੱਧੇ ਲੇਟ ਕੇ ਦਵਾਈ ਮਲਹਮ ਲਗਾ ਲਓ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਨਹੀਂ ਵੀ ਲੇਟਿਆ ਜਾ ਰਿਹਾ ਤਾਂ ਡਾਕਟਰ ਨੂੰ ਵਿਖਾਓ ਜੇ ਤੁਹਾਡੀ ਦੇ ਸਿੱਧੇ ਲੇਟਣ ਨਾਲ ਕਮਰ ਸਹੀ ਹੋ ਜਾਂਦੀ ਤਾਂ ਠੀਕ ਹੈ ਨਹੀਂ ਤਾਂ ਡਾਕਟਰ ਕੋਲ ਚਲੇ ਜਾਓ ਇਸ ਤੋਂ ਬਾਅਦ ਤੁਸੀਂ ਤੁਹਾਨੂੰ ਕਸਰਤ 'ਤੇ ਖਿਚਾਵ ਨਾ ਪਵੇ ਇਸ ਲਈ ਧਿਆਨ ਕਰਨੀ ਕਸਰਤ ਕਰ ਸਕਦੇ ਹੋ ਪਰ ਡਾਕਟਰ ਤੋਂ ਪੁੱਛ ਕੇ ਕਰਨੀ ਹੈ ਵੀ ਇਹ ਨਹੀਂ ਵੀ ਤੁਸੀਂ ਆਪਦੀ ਮਰਜ਼ੀ ਨਾਲ ਕਸਰਤ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਨੀਚੇ ਵਾਰੀ ਵਾਰੀ ਝੁਕਣਾ ਨਹੀਂ ਨਿਚੋਂ ਦੀ ਕੋਈ ਸਮਾਨ ਨਹੀਂ ਚੱਕਣਾ ਅਤੇ ਭਾਰੀ ਚੀਜ਼ ਨਹੀਂ ਚੱਕਣੀ ਪੌੜੀਆਂ ਨਹੀਂ ਚੜ੍ਹਨੀਆਂ ਅਤੇ ਆਪਦੇ ਆਪ ਨੂੰ ਸਿੱਧਾ ਲੇਟ ਕੇ ਰਖ ਥੋੜ੍ਹੀ ਥੋੜ੍ਹੀ ਦੇਰ ਬਾਅਦ ਸਿੱਧੇ ਲੇਟ ਜਾਣਾ ਜੇ ਤੁਹਾਨੂੰ ਸਰਦੀ ਨਹੀਂ ਵੀ ਤੁਸੀਂ ਰਸੋਈ 'ਚ ਕੰਮ ਕਰਨਾ ਜਾਂ ਆਪਦੇ ਕੋਈ ਕੰਮ ਜ਼ਰੂਰੀ ਹੈ ਤਾਂ ਕਰਕੇ ਸਿੱਧਾ ਲੇਟ ਜਾਣਾ ਸਿਰਹਾਣਾ ਨਹੀਂ ਲੈਣਾ ਪਤਲਾ ਗੱਦਾ ਵਿਛਾ ਲੈਣਾ ਬਿਲਕੁਲ ਜਿਹੜਾ ਤਖਤਪੋਸ਼ ਹੁੰਦਾ ਉਹਦੇ 'ਤੇ ਲੇਟ ਜਾਣਾ ਕਿਉਂਕਿ ਸਿੱਧੇ ਲੇਟਣ ਵਾਲੀ ਇਸ ਬਿਰ ਬਿਮਾਰੀ ਦਾ ਇਲਾਜ ਹੈ ਅਤੇ ਵਾਰ ਵਾਰ ਉਪਰ ਨੀਚੇ ਜਾਣ ਦੀ ਲੋੜ ਨਹੀਂ ਅਤੇ ਸਫਰ ਵੀ ਨਹੀਂ ਕਰਨਾ ਕਿਉਂਕਿ ਜ਼ਿਆਦਾ ਸਫਰ ਕਰੋਗੇ ਤਾਂ ਤੁਹਾਡੀ ਕਮਰ ਦਰਦ ਵੱਧ ਸਕਦੀ ਹੈ ਇਸ ਲਈ ਤੁਹਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ